ਅਸੀਂ ਮੀਡੀਆ ਵਿੱਚ ਸਿੱ ਪੰਜਾਬੀ ਸਿੱਖਿਆ ਪ੍ਰਣਾਲੀ ਭਾਸ਼ਾ ਨੂੰ ਬਹੁਤ ਹੀ ਉੱਚਿਤ ਰੂਪ ਦਿੱਤਾ ਹੈ ਜਿਵੇਂ ਮੈਂ ਅੱਜ ਦੇ ਸਮੇਂ ਦੀ ਗੱਲ ਕਰਾਂ ਵੀ ਮੀਡੀਆ ਵਿੱਚ ਜਿਵੇਂ ਔਨਲਾਈਨ ਸਿਸਟਮ ਲਾ ਲਓ ਹੈ ਨਾ ਔਨਲਾਈਨ ਸਿਸਟਮ ਦੇ ਵਿੱਚ ਜਿਵੇਂ ਆਪਾਂ ਚਰਖਾ ਸਰਚ ਕਰਨਾ ਹੈ ਨਾ ਸ ਚਰਖ਼ਾ ਅੱਜ ਦੇ ਬੱਚਿਆਂ ਨੂੰ ਪੁੱਛ ਲਓ ਤੁਸੀਂ ਉਹਨਾਂ ਨੂੰ ਚਰਖਾ ਨਹੀਂ ਪਤਾ ਹੋਵੇਗਾ ਪਰ ਉਹਨੇ ਜੇ ਜਾਨਣਾ ਚਾਹੁਣ ਚਾਉਂਦੇ ਆ ਉਹ ਤਾਂ ਉਹਨਾਂ ਨੂੰ ਉਹ ਭਰਨਗੇ ਚਰਖਾ ਤੋਂ ਚਰਖਾ ਆਟੋਮੈਟਿਕ ਹੀ ਉਹਨਾਂ ਨੂੰ ਤਸਵੀਰ ਦੇ ਰੂਪ ਵਿੱਚ ਸ਼ੋਅ ਕਰ ਦਿੱਤਾ ਪਰ ਪੁਰਾਣੇ ਸਮੇਂ ਵਿੱਚ ਲੋਕਾਂ ਦਾ ਜਿਹੜਾ ਇਕੱਠ ਹੁੰਦਾ ਸੀ ਉਹ ਬਹੁਤ ਵਧੀਆ ਹੁੰਦਾ ਸੀ ਜਿਵੇਂ ਚਰਖਾ ਕੱਤਣਾ ਮੰਜੇ ਬੁਣਨਾ ਪਾਣੀ ਭਰਨਾ ਇੱਕ ਢਾਕ 'ਤੇ ਬੱਚੇ ਨੂੰ ਚੁੱਕਿਆ ਹੁੰਦਾ ਹੈ ਦੂਜਰੇ ਦੂਸਰੇ ਹੱਥ 'ਤੇ ਬੱਚਾ ਚੁੱਕਿਆ ਹੁੰਦਾ ਇੱਕ ਪਾਸੇ ਪਸ਼ੂ ਖੜ੍ਹੇ ਆ ਇੱਕ ਪਾਸੇ ਖੂਹ ਤੋਂ ਬੀਬੀਆਂ ਪਾਣੀ ਲੈ ਜਾ ਰਹੀਆਂ ਆ ਰਹੀਆਂ ਹਨ ਆ ਰਹੀਆਂ ਹਨ ਵੀ ਇਹ ਚੀਜ਼ਾਂ ਜਿਹੜੀਆਂ ਸਨ ਸਾਡੀਆਂ ਅਲੋਪ ਹੋ ਰਹੀਆਂ ਹਨ ਜਿਵੇਂ ਚਰਖਾ ਵਰਡ ਹੈ ਪੰਜਾਬੀ ਵਿੱਚ ਜਿਹੜਾ ਹੈਗਾ ਸੀ ਜਿਵੇਂ ਮੈਂ ਪੁਰਾਣੇ ਸਮੇਂ ਦੀੇ ਚਰਖੇ ਦੇ ਵਿੱਚ ਗੁੱਡੀਆਂ ਯੂਜ ਹੁੰਦੀਆਂ ਸੀ ਤਕਲਾ ਵਰਤਿਆ ਜਾਂਦਾ ਸੀਗਾ ਚਰਮਖ ਅੱਜ ਦੇ ਬੱਚੇ ਨੂੰ ਪੁੱਛ ਲਓ ਚਰਮਖ ਕੀ ਹੁੰਦੀ ਹੈ ਤਾਂ ਉਹ ਨਹੀਂ ਉਹਨੂੰ ਨਹੀਂ ਪਤਾ ਹੈਗਾ ਵੀ ਚਰਮਖ ਕੀ ਹੋਊਗਾ ਹਾਂ ਅਗਰ ਉਹ ਔਨਲਾਈਨ ਸਰਚ ਕਰੂਗਾ ਹੈ ਨਾ ਵੀ ਚਰਮਖ ਮੈਂ ਜਾਨਣਾ ਚਾਹੁੰਦਾ ਤਾਂ ਇਹ ਬਹੁਤ ਵਧੀਆ ਸਿਸਟਮ ਹੋ ਚੁੱਕਿਆ ਹੈ ਪਰ ਹਾਂ ਜੇ ਉਸ ਬੱਚੇ ਨੂੰ ਐਟ ਅ ਟਾਈਮ ਪੁੱਛੋ ਨਾ ਚਰਮਖ ਕੀ ਹੁੰਦੀ ਹੈ ਤਾਂ ਉਹਨੂੰ ਨਹੀਂ ਪਤਾ ਹੋਊਗਾ ਜੇ ਉਸ ਬੱਚੇ ਨੇ ਆਪਣੇ ਲਈ ਜਾਨਣਾ ਚਾਹੁੰਦਾ ਫਿਰ ਉਹਨੂੰ ਸਰਚ ਕਰਕੇ ਉਹ ਆਪਣਾ ਜਿਹੜਾ ਪੰਜਾਬੀ ਭਾਸ਼ਾ ਨੂੰ ਅੱਗੇ ਵਧੀਆ ਵਾਧਾ ਕਰ ਸਕਦਾ ਆਪਣੇ ਆਪ ਨੂੰ ਵਧੀਆ ਈਨੂੰ ਅੱਗੇ ਈਨੂੰ ਨਹੀਂ ਪਤਾ ਅੱਜ ਦੇ ਬੱਚਿਆਂ ਨੂੰ ਈਨੂੰ ਕੀ ਹੁੰਦਾ ਲੋਕ ਪੁਰਾਣੇ ਘਰਾਂ ਦੇ ਵਿੱਚ ਟੈਨਾਂ ਪਾਉਂਦੇ ਸੀ ਸਰ ਪਾਉਂਦੇ ਸੀਗੇ ਲਟਾਨਾ ਲਟੈਣਾਂ ਹੁੰਦੀਆਂ ਸੀਗੀਆਂ ਵੱਡੀਆਂ ਵੱਡੀਆਂ ਜੋ ਕਿ ਅੱਜ ਕੱਲ੍ਹ ਨਹੀਂ ਪਤਾ ਅੱਜ ਕੱਲ੍ਹ ਨਵੀਂ ਨੀਤੀ ਆ ਗਈ ਹੈ ਬੱਚਿਆਂ ਨੂੰ ਅੱਜ ਕੱਲ੍ਹ ਦੇ ਬਾਰੇ ਕੰਪਿਊਟਰ ਨੌਲੇਜ ਬਹੁਤ ਹੈ ਪਰ ਪੁਰਾਣੇ ਕਲਚਰ ਬਾਰੇ ਕੁਝ ਨਹੀਂ ਪਤਾ ਸਾਡੀ ਬਾਬਾ ਨਾਨਕ ਜੀ ਦੇ ਟਾਈਮ ਦੀ ਗੱਲ ਕਰਾਂ ਪੈਂਤੀ ਅੱਖਰੀ ਊੜਾ ਆੜਾ ਅੱਜ ਕੱਲ੍ਹ ਬਹੁਤ ਘੱਟ ਬੱਚਿਆਂ ਨੂੰ ਇਹ ਊੜਾ ਆੜਾ ਆਉਂਦਾ ਪੂਰਾ ਕਿਸੇ ਨੂੰ ਵੀ ਆਉਂਦਾ ਪਰ ਪੂਰਾ ਉ ਪੂਰਾ ਊੜਾ ਆੜਾ ਨਹੀਂ ਬੋਲ ਸਕਦੇ ਜੇ ਉਹਨੂੰ ਦਸ ਜਣਿਆਂ ਦੇ ਇਕੱਠ ਵਿੱਚ ਕਹਿ ਦੋ ਤੁਸੀਂ ਉੜਾ ਆੜਾ ਸੁਣਾਓ ਨਹੀਂ ਸੁਣਾ ਸਕਦੇ ਉਹ ਕ ਉਹ ਉਲਝਣਗੇ ਕੰਬਣਗੇ ਕਿਉਂਕਿ ਅਸੀਂ ਮਾਤ ਭਾਸ਼ਾ ਨਾਲ ਜੁੜਨਾ ਚਾਹੁੰਦੇ ਹਾਂ ਪਰ ਪੰਜਾਬੀਆਂ ਨੂੰ ਜਿਹੜੀ ਸਾਡੀ ਉਹ ਇੱਕ ਮਾਤ ਭਾਸ਼ਾ ਮੈਂ ਆਪਣੇ ਵਿਚਾਰ ਇਹ ਹੀ ਆਖਦੀ ਹੈ ਵੀ ਸਾਨੂੰ ਆਪਣੇ ਪੁਰਾਣੇ ਕਲਚਰ ਨੂੰ ਵੀ ਆਉਣ ਵਾਲੀ ਪੀੜੀ ਨੂੰ ਦੱਸਣਾ ਚਾਹੀਦਾ ਹੈ ਜੋ ਮੀਡੀਆ ਕਰ ਰਹੀ ਹੈ ਉਹ ਬਿਲਕੁਲ ਠੀਕ ਹੈਗਾ ਇਸ ਲਈ ਅਸੀਂ ਪੰਜਾਬੀ ਭਾਸ਼ਾ ਨੂੰ ਇੱਕ ਉਚਿਤ ਰੂਪ ਦਿੱਤਾ ਹੁਣ ਸਰਕਾਰ ਨੇ ਵੀ ਪੰਜਾਬੀ ਆ ਜਿਹੜੀ ਭਾਸ਼ਾ ਉਹ ਇੱਕ ਨੰਬਰ 'ਤੇ ਰੱਖੀ ਹੁੰਦੀ ਜਿਵੇਂ ਹੁਣ ਆਪਾਂ ਰਸਤੇ ਦੇ ਵਿੱਚ ਜਾ ਰਹੇ ਹਾਂ ਆਪਾਂ ਪੰਜਾਬ ਦੇ ਹਾਂ ਪਹਿਲਾਂ ਵਰਡਿੰਗ ਇੱਕ ਇੰਗਲਿਸ਼ ਦੀ ਲਿਖੀ ਹੁੰਦੀ ਸੀਗੀ ਅੰਮ੍ਰਿਤਸਰ ਪਰ ਹੁਣ ਜਦੋਂ ਆਪਾਂ ਬੋੜ ਦੇਖਦੇ ਹਾਂ ਪੰਜਾਬੀ ਦੇ ਵਿੱਚ ਲਿਖਿਆ ਹੁੰਦਾ ਅੰਮ੍ਰਿਤਸਰ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਮੈਂ ਇਹ ਆਪਣੇ ਵਿਚਾਰ ਇਹ ਹੀ ਰੱਖਣਾ ਚਾਹੁੰਦੀ ਹਾਂ ਵੀ ਸਾਨੂੰ ਇਸ ਨੂੰ ਪੰਜਾਬੀ ਭਾਸ਼ਾ ਨੂੰ ਉਚਿਤ ਰੂਪ ਦੇਣਾ ਚਾਹ ਦੇਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੀ ਭਾਸ਼ਾ ਤੋਂ ਟੁੱਟ ਨਾ ਸਕੀਏ ਇਹ ਸਾਡੀ ਜਨਮ ਭੂਮੀ ਹੈ ਧੰਨਵਾਦ